ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਆਪਣਾ ਬਸ ਵਧੀਆ ਜੀ ਵਧੀਆ ਅੱਜ ਕੱਲ੍ਹ ਖਬਰਾਂ ਸੁਣਦਾ ਸੀ ਅਖਬਾਰਾਂ ਪੜ੍ਹਦੇ ਹਾਂ ਪੜ੍ਹਿਆ ਪੜ੍ਹਦਾ ਪਿਆ ਸੀ ਤਾਂ ਉਹਦੇ ਵਿੱਚ ਦੱਸਦੇ ਪਏ ਸੀ ਕਿ ਅੱਜ ਕੱਲ੍ਹ ਜਿਹੜੇ ਬੱਚੇ ਬਾਹਰ ਜਾ ਰਹੇ ਆ ਜੀ ਅਤੇ ਬਾਹਰ ਜਾਣ ਨੂੰ ਇੱਥੇ ਨਹੀਂ ਪੜ੍ਹ ਕੇ ਰਹਿ ਕੇ ਖੁਸ਼ ਨਹੀਂ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਮਤਲਬ ਕਿ ਬਾਹਰ ਲੋਕ ਹੁਣ ਬਾਹਰ ਜਾ ਜਾਂਦਾ ਜਾਂਦੇ ਆ ਜ ਆਪਣੇ ਸ਼ਹਿਰ ਦੇ ਵਿੱਚ ਜ਼ਿਆਦਾ ਬੈਟਰ ਨਹੀਂ ਰਹਿੰਦਾ ਜੀ ਠੀਕ ਹੈ ਠੀਕ ਹੈ ਬਾਕੀ ਬਾਕੀ ਇੱਥੇ ਹੈਗਾ ਅਤੇ ਕਈ ਹੁਣ ਜਿਵੇਂ ਬੱਚਿਆਂ ਨੂੰ ਉੱਥੇ ਸਹੂਲਤਾਂ ਕਾਫੀ ਮਿਲਦੀਆਂ ਵਾ ਕਿ ਜਿਵੇਂ ਇੱਥੇ ਮੈਡੀਸਨ ਵਗੈਰਾ ਸਭ ਕੁਛ ਸਹੂਲਤਾਂ ਵਗੈਰਾ ਉੱਥੇ ਲਾਗੇ ਕੋਈ ਨਹੀਂ ਲੱਗਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਬਸ ਵਧੀਆ ਵਧੀਆ ਅੱਛਾ ਜੀ ਅਤੇ ਚਲੋ ਮੈਂ ਨਾ ਤੁਹਾਨੂੰ ਨਾ ਦੁਬਾਰਾ ਕਰਦਾ ਵਾਂ ਮੈਂ ਬਾਹਰ ਜਾਣਾ ਜੀ ਜਰਾ ਕਿਤੇ ਅਤੇ ਮੈਂ ਤੁਹਾਨੂੰ ਬਾਅਦ 'ਚੋਂ ਕਰਦਾ ਠੀਕ ਹੈ ਭੈਣ ਜੀ ਠੀਕ ਹੈ ਜੀ ਓਕੇ ਚਲੋ ਮੈਂ ਬਾਅਦ 'ਚ ਕਰਦਾ